ਹਾਂਜੀ ਅੱਜ ਕੱਲ੍ਹ ਪੰਜਾਬ ਵਿੱਚ ਵੀ ਕਈ ਘੱਟ ਗਿਣਤੀ ਧਰਮ ਜਿਹੜੇ ਆ ਉਹ ਆ ਗਏ ਆ ਬਾਹਰੋਂ ਆਏ ਆ ਹੋਰ ਰਾਜਾਂ ਤੋਂ ਆ ਗਏ ਆ ਜਿਵੇਂ ਮੁਸਲਮਾਨ ਆ ਗਏ ਕਾਫੀ ਕ੍ਰਿਸ਼ਚਨਜ਼ ਆ ਗਏ ਆ ਹਿੰਦੂ ਆ ਗਏ ਆ ਅਸਲ ਵਿੱਚ ਪੰਜਾਬ ਦੇ ਵਿੱਚ ਲੇਬਰ ਦੀ ਲੋੜ ਹੋਣ ਕਰਕੇ ਇਹ ਲੋਕ ਜਾਂ ਪੰਜਾਬ ਦਾ ਖਿੱਤਾ ਜਿਹੜਾ ਅਮੀਰ ਖਿੱਤਾ ਹੋਣ ਕਰਕੇ ਖੇਤੀਬਾੜੀ ਕਰਕੇ ਇੱਥੇ ਲੇਬਰ ਹ ਸਾਰਾ ਸਾਲ ਚਾਹੀਦੀ ਹੁੰਦੀ ਹੈ ਸੋ ਜਿਹੜੇ ਬਾਕੀ ਰਾਜਾ ਜਿਵੇਂ ਬਿਹਾਰ ਵਗੈਰਾ ਏ ਆ ਯਾ ਯੂ ਪੀ ਆ ਜਿੱਥੇ ਪੈਦਾਵਾਰ ਘੱਟ ਹੁੰਦੀ ਹੈ ਯਾ ਕੰਮ ਕਾਰ ਦਾ ਜਿਹੜਾ ਚੱਕਰ ਘੱਟ ਹੈ ਉਹ ਲੋਕ ਰੋਟ ਰੋਜ਼ੀ ਰੋਟੀ ਦੀ ਖਾਤਰ ਇਧਰ ਆ ਰਹੇ ਆ ਪੰਜਾਬ ਦੇ ਵਿੱਚ ਕੁਝ ਸਥਾਈ ਤੌਰ 'ਤੇ ਆ ਗਏ ਕੁਝ ਅਸਥਾਈ ਤੌਰ 'ਤੇ ਆ ਗਏ ਆ ਸੋ ਇਹਨਾਂ ਦੇ ਵਿੱਚ ਇਹ ਮੁਸਲਮਾਨ ਹਿੰਦੂ ਯਾ ਕਿ ਕ੍ਰਿਸ਼ਚਨਜ਼ ਕਾਫੀ ਆ ਗਏ ਆ ਇਹ ਸੋ ਅੱਜ ਕੱਲ੍ਹ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੇ ਇਹ ਘੱਟ ਗਿਣਤੀ ਧਰਮ ਜਿਹੜੇ ਹੈਗੇ ਆ ਕਾਫੀ ਹੱਦ ਤੱਕ ਮੌਜੂਦ ਹੈ ਅਤੇ ਚੱਲ ਰਹੇ ਆ ਮਾਨਤਾ ਮਿਲੀ ਹੋਈ ਆ ਇਹਨਾਂ ਨੂੰ